ਜਦੋਂ ਅਸੀਂ ਕੋਈ ਵੀ ਖਾਣਾ ਬਣਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਆਲਾ ਦੁਆਲਾ ਸਾਫ਼ ਹੋਣਾ ਚਾਹੀਦਾ ਹੈ ਸਾਨੂੰ ਬਰਤਨਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ਅਸੀਂ ਹੋ ਸਕੇ ਹੋ ਸਕੇ ਤਾਂ ਅਸੀਂ ਖਾਣਾ ਚੁੱਲ੍ਹੇ 'ਤੇ ਬਣਾਉਣਾ ਚਾਹੀਦਾ ਹੈ ਅਤੇ ਸਾਨੂੰ ਕੱਚੇ ਬਰਤਨ ਵਿੱਚ ਹੀ ਖਾਣਾ ਬਣਾਉਣਾ ਚਾਹੀਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਸਾਨੂੰ ਖਾਣਾ ਬਣਾਉਣ ਸਮੇਂ ਸਿਰਫ਼ ਤੇਲ ਅਤੇ ਖੋਪੇ ਦੇ ਤੇਲ ਦੀ ਹੀ ਵਰਤੋਂ ਕਰਨੀ ਚਾਹੀਦਾ ਹੈ ਵੱਧ ਤੋਂ ਵੱਧ ਅਸੀਂ ਦੇਸੀ ਘਿਓ ਦੀ ਵੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਅਸੀਂ ਡਾਲਡਾ ਘਿਓ ਅਤੇ ਰਫੈਂਡ ਤੇਲ ਦੀ ਵਰਤੋਂ ਨਹੀਂ ਕਰ ਸਕਦੇ ਰਫੈਂਡ ਤੇਲ ਅਤੇ ਡਾਲਡਾ ਘਿਓ ਦੀ ਵਰਤੋਂ ਕਰਨੀ ਵੀ ਨਹੀਂ ਚਾਹੀਦੀ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਜੇਕਰ ਅਸੀਂ ਸਰ੍ਹੋਂ ਦੇ ਤੇਲ ਨੂੰ ਵੀ ਵਾਰ ਵਾਰ ਫਰਾਈ ਕਰਕੇ ਉਸੇ ਵਿੱਚ ਜਿਵੇਂ ਪਕੌੜੇ ਪਕੌੜਿਆਂ ਵਾਲਾ ਤੇਲ ਉਸਨੂੰ ਵਾਰ ਵਾਰ ਯੂਜ ਕਰਕੇ ਉਹ ਵੀ ਇੱਕ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਸਰ੍ਹੋਂ ਦੇ ਤੇਲ ਨੂੰ ਇੱਕ ਵਾਰੀ ਹੀ ਫਰਾਈ ਕਰਕੇ ਉਸਨੂੰ ਯੂਜ ਕਰ ਲੈਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਖਾਣਾ ਬਣਾਉਣ ਤੋਂ ਬਾਅਦ ਉਸ ਖਾਣੇ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਆਦਿ ਬਿਮਾਰੀਆਂ ਤੋਂ ਬੱਚ ਸਕੀਏ ਮੱਖੀ ਮੱਛਰ ਆਦਿ ਤੋਂ ਸਾਨੂੰ ਬਚਾਓ ਕਰਨਾ ਚਾਹੀਦਾ ਹੈ ਅਤੇ ਇਹ ਸਾਨੂੰ ਹਮੇਸ਼ਾ ਸਾਫ਼ ਸੁਥਰਾ ਆਲਾ ਦੁਆਲਾ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਜੋ ਸਿਹਤਮੰਦ ਫਿੱਟ ਰਹੀਏ ਧੰਨਵਾਦ